ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਮੈਮ ਵਧੀਆ ਮੈਮ ਮੈਮ ਐਕਚੁਲੀ ਮੈਮ ਤੁਹਾਡੀ ਹੈਲਪ ਚਾਹੀਦੀ ਸੀ ਮੇਰੀ ਨਾ ਇੱਕ ਫਰੈਂਡ ਹੈ ਮਨਪ੍ਰੀਤ ਤੁਸੀਂ ਜਾਣਦੇ ਹੋਣੇ ਉਹਨੂੰ ਉਹਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਐਕਚੁਲੀ ਮੈਂ ਇੱਥੇ ਨਵੀਂ ਆਈ ਹਾਂ ਨਾ ਤਾਂ ਮੈਨੂੰ ਇੱਥੇ ਥੋੜ੍ਹੀ ਸ਼ੋਪਿੰਗ ਕਰਨ 'ਚ ਪ੍ਰੋਬਲਮ ਹੋ ਰਹੀ ਹੈ ਐਕਚੁਅਲੀ ਮੈਂ ਜੁੱਤੀਆਂ ਵਗੈਰਾ ਲੈਣੀਆਂ ਸੀਗੀਆਂ ਤੁਸੀਂ ਕੋਈ ਸ਼ੋਪ ਸੁਜੈਸਟ ਕਰ ਸਕਦੇ ਹੋ ਨੇੜੇ ਤੇੜੇ ਹਾਂਜੀ ਹਾਂਜੀ ਅਤੇ ਮੈਮ ਇੱਥੇ ਇਕੱਲੀ ਜੁੱਤੀਆਂ ਵਗੈਰਾ ਦੀਆਂ ਜਾਂ ਸੂਟ ਵਗੈਰਾ ਬਾਕੀ ਕੁਛ ਵੀ ਅਵੇਲੇਬਲ ਹੈਗਾ ਓਕੇ ਮੈਮ ਜਵੈਲਰੀ ਵਗੈਰਾ ਵੀ ਸਾਰਾ ਕੁ ਸਭ ਕੁਛ ਨਾਲ ਦਿੰਦੇ ਹੈ ਜਾਂ ਅਲੱਗ ਹੀ ਲੈਣਾ ਪੈਂਦਾ ਉਹ ਵੀ ਓਕੇ ਮੈਮ ਅਗਰ ਰੈਂਟ 'ਤੇ ਕਰਨਾ ਹੋਏ ਕੁਛ ਤਾਂ ਥੋੜ੍ਹੇ ਦਿਨਾਂ ਲਈ ਮਤਲਬ ਕਿ ਵਿਆਹ ਸ਼ਾਦੀ ਲਈ ਜਿਵੇਂ ਰੈਂਟ 'ਤੇ ਲੈਂਦੇ ਆਪਾਂ ਉਹ ਕੁਛ ਵੀ ਅਵੇਲੇਬਲ ਹੈ

ਹਾਂਜੀ ਹਾਂਜੀ ਹਾਂਜੀ ਉਹ ਤਾਂ ਜੁੱਤੀ ਤਾਂ ਚਲੋ ਆਪਣੀ ਹੀ ਲੈਣੀ ਪੈਂਦੀ ਹੈ ਬਾਕੀ ਮੈਂ ਪੁੱਛਦੀ ਸੀ ਅਗਰ ਰੈਂਟ 'ਤੇ ਵੀ ਮਿਲ ਜਾਂਦਾ ਥੋੜ੍ਹਾ ਨੇੜੇ ਹੈ ਨਾ ਬਜਟ ਦੇ ਵਿੱਚ ਹਾਂਜੀ ਹਾਂਜੀ ਲੈਣਾ ਤਾਂ ਹਲਕਾ ਹੀ ਹੈ ਕਿਉਂਕਿ ਵਿਆਹ ਸ਼ਾਦੀ ਦੇ ਵਿੱਚ ਤੁਹਾਨੂੰ ਪਤਾ ਪੈਂਦਾ ਨਹੀਂ ਐਨਾ ਠੀਕ ਹੈ ਜੀ ਓਕੇ ਮੈਮ ਥੈਂਕ ਯੂ ਸੋ ਮੱਚ